ਕੁੜੀਆ ਔਰਤਾਂ ਅਤੇ ਲੜਕਿਆਂ ਪੁਰਸ਼ਾਂ ਦੁਆਰਾ ਖੇਡਾਂ ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਕੀ ਕੋਈ ਫ਼ਰਕ ਹੈ ਕੁੜੀਆਂ ਅੱਜ ਕੱਲ੍ਹ ਅ ਖੋ ਖੋ ਕਬੱਡੀ ਖੋ ਖੋ ਵੀ ਖੇਡੀ ਜਾਂਦੀਆਂ ਬੈਡਮਿੰਟਨ ਵੀ ਖੇਡੀ ਜਾਂਦੀਆਂ ਅਤੇ ਅ ਵਾਲੀਬੋਲ ਵੀ ਖੇਡਦੀਆਂ ਅਤੇ ਕਬੱਡੀ ਸਾਰਾ ਖੇਡੀ ਜਾਂਦੀਆਂ ਅਤੇ ਉਹ ਕੋਈ ਫ਼ਰਕ ਨਹੀਂ ਹੈਗਾ ਅੱਜ ਕੱਲ੍ਹ ਉਹ ਹੀ ਜੋ ਮ ਮੁੰਡੇ ਖੇਡਦੇ ਆ ਅਤੇ ਉਹ ਹੀ ਕੁੜ ਕੁੜੀਆਂ ਖੇਡੀ ਜਾਂਦੀਆਂ ਹੈ ਰੱਸਾਕੱਸ਼ੀ ਹੋ ਗਏ ਅਤੇ ਆਪਣਾ ਕਬੱ ਕਬੱਡੀ ਬੈਡਮਿੰਟਨ ਖੋ ਖੋ ਅਤੇ ਆਪਣਾ ਸਾ ਸਾਰਾ ਹੀ ਖੇਡਾਂ ਖੇਡੀ ਜਾਂਦੀਆਂ ਅਤੇ ਬੈਟ ਬੋਲ ਹੋ ਗਏ ਆਪਣਾ ਚਰਖ਼ਾ ਅਤੇ ਆਪਣਾ ਰੱਸੀ ਕੱਸ਼ਾ ਹੋ ਗਿਆ ਅਤੇ ਬ ਬਹੁਤ ਆ